ਮੈਂ ਕਿਸੇ ਕੰਪਨੀ ਤੋਂ ਆਪਣੇ ਭਤੀਜੇ ਰਾਹੀਂ ਕੱਪੜੇ ਦੇ ਬੂਟ ਮੰਗਵਾਏ ਸੀ ਜੋ ਕਿ ਬਹੁਤ ਹੀ ਵਧੀਆ ਅਤੇ ਹੰਢਣਸਾਰ ਨਿਕਲੇ ਮੈਂ ਇਹ ਬੂਟ ਆਨਲਾਈਨ ਕੰਪਨੀ ਤੋਂ ਮੰਗਵਾਏ ਸੀ ਅਤੇ ਜੋ ਬਹੁਤ ਵਧੀਆ ਹਲਕੇ ਹੰਢਣ ਅਨੁਸਾਰ ਅਤੇ ਵਧੀਆ ਕੁਆਲਿਟੀ ਦੇ ਵਿੱਚ ਵਧੀਆ ਹੰਡਣਸਾਰ ਮੈਨੂੰ ਲੱਗੇ ਮੈਂ ਦੁਬਾਰਾ ਫਿਰ ਇਹਨਾਂ ਬੂਟਾਂ ਦਾ ਔਡਰ ਕੀਤਾ ਅਤੇ ਜੋ ਕਿਸੇ ਬਜ਼ਾਰ ਨਾਲੋਂ ਵੀ ਬਹੁਤ ਕੀਮਤ ਘੱਟ ਹੈਗੀ ਅਤੇ ਦੂਜੀਆਂ ਕੰਪਨੀਆਂ ਨਾਲੋਂ ਵੀ ਇਹਦੀ ਕੀਮਤ ਬਹੁਤ ਘੱਟ ਆ ਅਤੇ ਹੰਢਦੇ ਵੀ ਬਹੁਤ ਵਧੀਆ ਹਨ ਮੈਨੂੰ ਇਹ ਬਹੁਤ ਹੀ ਵਧੀਆ ਲੱਗੇ ਅਤੇ ਹੰਢਣਸਾਰ ਲੱਗੇ ਮੈਂ ਦੁਬਾਰਾ ਫਿਰ ਇਸ ਕੰਪਨੀ ਨੂੰ ਇਹਨਾਂ ਬੂਟਾਂ ਵਾਸਤੇ ਔਡਰ ਕਰਦਾ ਅਤੇ ਹੋਰ ਵੀ ਇਹ ਕਿਸੇ ਮੇਰੇ ਭੈਣ ਭਾਈ ਨੇ ਮੰਗਵਾਉਣੇ ਹਨ ਤਾਂ ਮੈਂ ਔਨਲਾਈਨ ਕੰਪਨੀ ਤੋਂ ਇਹ ਬੂਟ ਮੰਗਵਾ ਸਕਦਾ